ਜਿਵੇਂ ਕਿ ਪੰਜਾਬ ਇੱਕ ਅਮੀਰ ਵਿਰਸਾ ਹੈ ਇਸ ਦੇ ਨਾਲ ਹੀ ਇਸ ਵਿੱਚ ਕਿੰਨੇ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਹਨ ਕਿੰਨੇ ਲੇਖਕ ਹਨ ਚਾਹੇ ਉਹ ਵਾਰਿਸ ਸ਼ਾਹ ਹੋਵੇ ਚਾਹੇ ਬਾਬਾ ਬੁੱਲੇ ਸ਼ਾਹ ਹੋਏ ਚਾਹੇ ਭਗਤ ਪੂਰਨ ਸਿੰਘ ਹੋਣ ਚਾਹੇ ਪ੍ਰੋਫੈਸਰ ਵੀਰ ਸਿੰਘ ਹੋਣ ਚਾਹੇ ਸੁਰਜੀਤ ਪਾਤਰ ਜੀ ਹੋਣ ਜਾਂ ਫਿਰ ਜਾਂ ਫਿਰ ਅੰਮ੍ਰਿਤਾ ਪ੍ਰੀਤਮ ਜੀ ਹੋਣ ਕਿੰਨੇ ਹੀ ਤਰ੍ਹਾਂ ਦੇ ਕਿੰਨੇ ਹੀ ਤਰ੍ਹਾਂ ਦੇ ਮਹਾਨ ਕਲਾਕਾਰ ਲੇਖਕ ਅਤੇ ਕਵੀ ਹੋਏ ਹਨ ਜਿਹਨਾਂ ਨੇ ਪੰਜਾਬੀ ਵਿਰਸਾ ਬੜੇ ਚੰਗੇ ਤਰੀਕੇ ਨਾਲ ਅੱਖਰਾਂ ਵਿੱਚ ਸੰਜੋਇਆ ਹੈ ਇਸ ਤਰ੍ਹਾਂ ਅਸੀਂ ਆਪਣੇ ਸਥਾਨ 'ਤੇ ਸਥਾਨਕ ਕਲਾਕਾਰਾਂ ਦੀ ਇਕੱਲੇ ਕਲਾਕ੍ਰਿਤੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾ ਸਕਦੇ ਹਾਂ ਜਿਵੇਂ ਕਿ ਹੁਣ ਅੱਜ ਕੱਲ੍ਹ ਕਿੰਨੀਆਂ ਹੀ ਸੰਸਥਾਵਾਂ ਖੁੱਲ੍ਹੀਆਂ ਹਨ ਜੋ ਕਿ ਆਪਣੇ ਪੰਜਾਬ ਦੇ ਵਿਰਸੇ ਨੂੰ ਸੰਭਾਲ ਕੇ ਰੱਖਦੀਆਂ ਹਨ ਜਾਂ ਫਿਰ ਜਾਂ ਫਿਰ ਜੋ ਜਾਂ ਫਿਰ ਜਿਵੇਂ ਕਿ ਪੰਜਾਬ ਦੇ ਵਿੱਚ ਸਿੱਖੀ ਸਿੱਖੀ ਧਰਮ ਜ਼ਿਆਦਾਤਰ ਚੱਲਦਾ ਹੈ ਜਾਂ ਫਿਰ ਸਿੱਖੀ ਧਰਮ ਦੀਆਂ ਜੋ ਆਪਣੇ ਮੂਲ ਮੂਲ ਹਨ ਉਹਨਾਂ ਨੂੰ ਸੰਭਾਲ ਕੇ ਰੱਖਦੀਆਂ ਹਨ ਜਿਵੇਂ ਕਿ ਮੇਰੀ ਨੌਲੇਜ ਵਿੱਚ ਇੱਕ ਲੁਧਿਆਣਾ ਵਿੱਚ ਸੁੱਚਾ ਜੀ ਫਾਊਂਡੇਸ਼ਨ ਹੈ ਇਸ ਦੇ ਨਾਲ ਹੀ ਐਜ ਪੰਜਾਬ ਐਜੂਕੇਟ ਪ੍ਰੋਜੈਕਟ ਹੈ ਜੋ ਕਿ ਕਿੰਨੇ ਦੇ ਕਿੰਨੇ ਹੀ ਵਿਦਿਆਰਥੀ ਜਿਹਨਾਂ ਨੂੰ ਜਿਹਨਾਂ ਨੂੰ ਪੜ੍ਹਾਈ ਜਿਹਨਾਂ ਨੂੰ ਪੜ੍ਹਾਈ ਪ੍ਰੋਵਾਈਡ ਕਰਵਾ ਰਿਹਾ ਜਿਵੇਂ ਕਿ ਕਈ ਮਾਪੇ ਹੁੰਦੇ ਹਨ ਜਿਹਨਾਂ ਕੋਲ ਪੈਸੇ ਨਹੀਂ ਹੁੰਦੇ ਜੋ ਕਿ ਬੱਚਿਆਂ ਨੂੰ ਪੜ੍ਹਾ ਨਹੀਂ ਸੀ ਸਕਦੇ ਤਾਂ ਉਹਦੇ ਐਜ ਪੰਜਾਬ ਐਜੂਕੇਟ ਪ੍ਰੋਜੈ ਪੰਜਾਬ ਐਜੂਕੇਟ ਪ੍ਰੋਜੈਕਟ ਵਿੱਚ ਕੀ ਹੁੰਦਾ ਹੈ ਕਿ ਵੀ ਹਰ ਇੱਕ ਇਨਸਾਨ ਹਰ ਇੱਕ ਪੰਜਾਬ ਦਾ ਰਹਿਣ ਹਰ ਇੱਕ ਇਨਸਾਨ ਜੋ ਬਾਹਰ ਦਾ ਰਹਿਣ ਵਾਲਾ ਜਾਂ ਫਿਰ ਜਿੱਥੋਂ ਮਰਜ਼ੀ ਦਾ ਵੀ ਉਹ ਇੱਕ ਬੱਚਾ ਅਡੋਪਟ ਕਰਦਾ ਹੈ ਅਤੇ ਉਸ ਦੀ ਪੜ੍ਹਾਈ ਪੂਰੀ ਕਰਵਾਉਂਦਾ ਹੈ ਇਹ ਕਿੰਨਾ ਹੀ ਸੋਹਣਾ ਤਰੀਕਾ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣ ਦਾ ਅਤੇ ਆਪਸ ਵਿੱਚ ਮੇਲ ਆਪਸ ਵਿੱਚ ਮੇਲ ਵਧਾਉਣ ਦਾ ਇਸ ਤਰ੍ਹਾਂ ਕੀ ਹੈ ਅਸੀਂ ਆਪਦੇ ਜਿਹੜੇ ਨਵੀਂ ਆਉਣ ਵਾਲੀ ਪੀੜ੍ਹੀ ਨੂੰ ਵੀ ਮੋਟੀਵੇਟ ਕਰ ਸਕਦੇ ਹਾਂ ਇਸ ਦੇ ਨਾਲ ਹੀ ਜਿਵੇਂ ਸੁੱਚਾ ਜੀ ਫਾਊਂਡੇਸ਼ਨ ਹੈ ਉਹ ਕਿਤਾਬਾਂ ਨੂੰ ਕ ਉਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਏ ਬੀ ਸੀ ਰੀਡਰਸ ਉਹਦੇ ਵਿੱਚ ਕੀ ਹੈ ਉਹ ਬੱਚਿਆਂ ਨੂੰ ਜ਼ਿਆਦਾਤਰ ਕਿਤਾਬਾਂ ਦੇ ਨਾਲ ਜੋੜਦੇ ਹਨ ਜਿਵੇਂ ਕਿ ਬੱਚੇ ਕਿਉਂਕਿ ਕਿਤਾਬਾਂ ਕੀ ਹਨ ਗਿਆਨ ਦਾ ਭੰਡਾਰ ਤਾਂ ਆਪਾਂ ਹਮੇਸ਼ਾ ਕੀ ਆ ਗਿਆਨ ਕਿਤਾਬਾਂ ਤੋਂ ਲੈ ਸਕਦੇ ਹਾਂ ਆਪਾਂ ਆਪਦੇ ਆਲੇ ਦੁਆਲੇ ਤੋਂ ਵੀ ਲੈ ਸਕਦੇ ਹਾਂ ਪਰ ਪਹਿਲਾ ਸੋਰਸ ਹਮੇਸ਼ਾ ਕਿਤਾਬਾਂ ਹੀ ਹੁੰਦੀਆਂ ਹਨ ਬੱਚਾ ਪੈਦਾ ਹੋਣ ਤੋਂ ਬਾਅਦ ਸਾਰਿਆਂ ਨਾਲੋਂ ਪਹਿਲੀ ਥਾਂ ਕਿੱਥੇ ਆ ਸਕੂਲ ਹੀ ਜਾਂਦਾ ਹੈ ਅਤੇ ਸਕੂਲ ਤੋਂ ਸਕੂਲ ਵਿੱਚੋਂ ਕਿਤਾਬਾਂ ਪੜ੍ਹਦਾ ਹੈ ਇਸ ਤਰ੍ਹਾਂ ਹੀ ਉਹ ਕੀ ਆ ਹਰ ਇੱਕ ਨੂੰ ਕਿਤਾਬਾਂ ਦੇ ਨਾਲ ਜੋੜਦੇ ਹਨ ਕਿਤਾਬਾਂ ਨਾਲ ਜੋੜਦੇ ਹਨ ਤਾਂ ਕਿ ਉਹ ਕੀ ਆ ਨੌਲੇਜ ਗੇਨ ਕਰ ਸਕਣ